ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤੁਹਾਡੇ ਸਕੂਲ 'ਚ ਐਡਮਿਸ਼ਨ ਲੈਣ ਦੇ ਰਿਗਾਰਡਿੰਗਲੀ ਪੁੱਛਣਾ ਸੀਗਾ ਕੁਛ ਪੁੱਛ ਸਕਦਾ ਸਰ ਜੇ ਟਾਈਮ ਹੈਗਾ ਤਾਂ ਸਰ ਮੈਂ ਥੈਂਕ ਯੂ ਸੋ ਮੱਚ ਸਰ ਸਰ ਐਕਚੁਅਲੀ ਮੈਂ ਨਾ ਸਪੋਰਟਸ ਕੋਟੇ ਤੋਂ ਬਿਲੋਂਗ ਕਰਦਾ ਹਾਂ ਸਪੋਰਟਸ ਮੇਰੇ ਪੈਸ਼ਨ ਹੈਗਾ ਮੈਂ ਤੁਹਾਡੇ ਕੋਲ ਪੁੱਛਣਾ ਸੀਗਾ ਜਦੋਂ ਮੈਂ ਤੁਹਾਡੇ ਸਕੂਲੇ ਐਡਮਿਸ਼ਨ ਲੈਂਦਾ ਅਤੇ ਸਪੋਰਟ ਦੇ ਰਿਗਾਰਡਿੰਗਲੀ ਮੈਨੂੰ ਕਿਹੜੀਆਂ ਕਿਹੜੀਆਂ ਫੈਸਿਲਟੀਜ਼ ਵਗੈਰਾ ਮਿਲ ਸਕਦੀਆਂ ਨੇ ਅਗਰ ਮੈਂ ਸਪੋਰਟਸ ਵਿੱਚ ਕੋਈ ਪਾਰਟੀਸਪੇਟ ਕਰਨਾ ਹੋਏ ਤਾਂ ਸਰ ਮੈਂ ਤਿੰਨ ਸਪੋਰਟਸ ਨਾਲ ਡਲੀ ਡੀਲ ਵੈਸੇ ਕਰ ਲੈਂਦਾ ਵਾਂ ਮੇਨ ਜਿਹੜੀ ਪ੍ਰੈਫਰੈਂਸ ਹੈ ਉਹ ਮੇਰੀ ਕ੍ਰਿਕਟ ਨੂੰ ਆ ਬਾਕੀ ਮੈਂ ਬਾਸਕਿਟਬੋਲ ਅਤੇ ਵੋਲੀਬੋਲ ਵੀ ਖੇਡ ਲੈਂਦਾ ਬਾਕੀ ਅਗਰ ਮੈਂ ਠੀਕ ਹੈ ਜੀ ਠੀਕ ਆ ਹਾਂ ਮੈਂ ਸੁਣਿਆ ਹੋਇਆ ਨਾਮ ਉਹਦਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਅਤੇ ਸਰ ਜਿਹੜੀ ਫੀਸ ਸਟੱਕਚਰ ਹੁੰਦਾ ਉਹ ਸਾਲ ਦਾ ਹੀ ਰਹਿੰਦਾ ਜਾਂ ਕਿ ਮਹੀਨੇ ਮਹੀਨੇ ਦਾ ਰਹਿੰਦਾ ਠੀਕ ਹੈ ਠੀਕ ਹੈ ਸਰ ਅਤੇ ਅਗਰ ਸਰ ਅੱਗੇ ਮੈਂ ਤੁਹਾਡੇ ਕੋਲੋਂ ਸਿੱਖ ਕੇ ਅੱਗੇ ਵੀ ਮੇਰੀ ਅਪਰੋਚ ਜਾ ਸਕਦੀ ਹੈ ਅਗਰ ਮੈਂ ਵਧੀਆ ਖੇਡਣਾ ਚਾਹਵਾਂ ਜਾਂ ਇੰਟਰਨੈਸ਼ਨਲ ਜਾਂ ਰਣਜੀ ਟਰੋਫੀ ਤੱਕ ਖੇਡਣਾ ਚਾਹਵਾਂ ਤਾਂ ਤੁਸੀਂ ਅੱਗੇ ਅਪਰੋਚ ਕਰ ਹਾਂਜੀ ਸਰ ਠੀਕ ਆ ਠੀਕ ਹੈ ਸਰ ਠੀਕ ਹੈ ਚਲੋ ਠੀਕ ਹੈ ਸਰ ਮੈਂ ਬਾਕੀ ਸਰ ਆ ਕੇ ਤੁਹਾਨੂੰ ਮਿਲਦਾ ਦੈਨ ਮੈਂ ਸਾਰੇ ਫੀਸ ਸਟੱਕਚਰ ਬਾਰੇ ਅਤੇ ਬਾਕੀ ਚੀਜ਼ਾਂ ਤੁਹਾਡੇ ਨਾਲ ਆ ਕੇ ਮਿਲ ਕੇ ਗੱਲ ਕਰਦਾਂ ਥੈਂਕ ਥੈਂਕ ਯੂ ਸੋ ਮੱਚ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ